ਸਮਾਜ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਕਾਨੂੰਨੀ ਪ੍ਰਣਾਲੀ ਵਿੱਚ ਇਹ ਸੁਧਾਰ ਕੀਤਾ ਜਾਣਾ ਚਾਹੀਦਾ ਕਿ ਜਿਹੜੇ ਕਾਨੂੰਨ ਦੇ ਰਖਵਾਲੇ ਪੁਲਿਸ ਮਹਿਕਮਾ ਹੈ ਉਹਨਾਂ ਨੂੰ ਆਪਣਾ ਕੰਮ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਕਿਉਂਕਿ ਜਿਹੜਾ ਸਾਡਾ ਪੁਲਿਸ ਮਹਿਕਮਾ ਅੱਜ ਕੱਲ ਬਹੁਤ ਜ਼ਿਆਦਾ ਭ੍ਰਿ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਉਹ ਲੋਕਾਂ ਤੋਂ ਪੈਸੇ ਖਾਈ ਜਾਂਦੇ ਆ ਹੈ ਨਾ ਕੰਮ ਆਪਣਾ ਸਹੀ ਤਰੀਕੇ ਨਾਲ ਨਹੀਂ ਕਰ ਕਰਦੇ ਹੈਗੇ ਤਾਂ ਹੀ ਨਾਗਰਿਕਾਂ ਨੂੰ ਸਹੀ ਤਰੀਕੇ ਨਾਲ ਸੁਰੱਖਿਆ ਨਹੀਂ ਪ੍ਰਦਾਨ ਹੁੰਦੀ ਇਸ ਕਰਕੇ ਦੇਸ਼ 'ਚ ਅਸ਼ਾਂਤੀ ਫੈਲੀ ਹੋਈ ਹੈ ਇਹ ਅਸ਼ਾਂਤੀ ਫੈਲਣ ਲ ਇਸ ਕਰਕੇ ਰੋਕੀ ਜਾ ਸਕਦੀ ਹੈ ਜੇਕਰ ਜਿਹੜੇ ਪੁਲਿਸ ਦੇ ਰਖਵਾਲੇ ਉਹ ਆਪਣਾ ਕੰਮ ਸਹੀ ਤਰੀਕੇ ਨਾਲ ਕਰਨ ਦੇਸ਼ 'ਚ ਵੱਧ ਰਹੇ ਅਪਰਾਧ ਦੀ ਦਰ ਵੀ ਇਸ ਕਰਕੇ ਵੱਧ ਰਹੀ ਹੈ ਕਿਉਂਕਿ ਜਿਹੜੇ ਅਪਰਾਧ ਕਰਨ ਵਾਲੇ ਵਿਅਕਤੀ ਆ ਉਹਨਾਂ ਨੂੰ ਏਦਾਂ ਲੱਗਦਾ ਵੀ ਜਿਹੜਾ ਪੁਲਿਸ ਮਹਿਕਮੇ ਦੇ ਵਿਅਕਤੀ ਹੈ ਉਹ ਰਿਸ਼ਵਤ ਖਾਂਦੇ ਆ ਅਤੇ ਅਸੀਂ ਉਹਨਾਂ ਨੂੰ ਰਿਸ਼ਵਤ ਦੇ ਕੇ ਹੈ ਨਾ ਅਪਰਾਧ ਭੁਗਤਣ ਦੀ ਜਿਹੜੀ ਸਜ਼ਾ ਉਹ ਤੋਂ ਅਸੀਂ ਬੱਚ ਜੂੰਗੇ ਵੀ ਸਾਨੂੰ ਜਿਹੜੀ ਸਜ਼ਾ ਹੋਣੀ ਆ ਅਸੀਂ ਉਹਨਾਂ ਨੂੰ ਰਿਸ਼ਵਤ ਦੇ ਦੇਵਾਂਗੇ ਅਤੇ ਅਸੀਂ ਓ ਸਜ਼ਾ ਭੁਗਤਣ ਤੋਂ ਬੱਚ ਜੂੰਗੇ ਅਗਰ ਪੁਲਿਸ ਮਹਿਕਮਾ ਸਹੀ ਤਰੀਕੇ ਨਾਲ ਆਪਣਾ ਕੰਮ ਕਰੇ ਤਾਂ ਹੀ ਅਪਰਾਧ ਦੀ ਦਰ ਨੂੰ ਘਟਾਇਆ ਜਾ ਸਕਦਾ ਅਤੇ ਇਸ ਤਰ੍ਹਾਂ ਹੀ ਅਪਰਾਧ ਹੋਣ ਤੋਂ ਬਚਾਇਆ ਜਾ ਸਕਦਾ ਹੈ